ਜ਼ਿਆਦਾਤਰ ਮੈਨੂੰ ਧਾਰਮਿਕ ਫੋਟੋਆਂ ਖਿੱਚਣੀਆਂ ਪਸੰਦ ਹੈਗੀਆਂ ਆ ਮੈਂ ਮੰਦਰ ਜਾਵਾਂ ਤਾਂ ਮੈਂ ਭਗਵਾਨਾਂ ਦੀਆਂ ਅਤੇ ਘਰ ਦੇ ਵਿੱਚ ਵੀ ਕੋਈ ਵੀ ਧਾਰਮਿਕ ਅ ਫੈਸਟੀਵਲ ਹੋਵੇ ਤਾਂ ਮੈਂ ਉਹਨਾਂ ਵਿੱਚ ਹੀ ਕਰਦੀ ਹਾਂ ਫੋਟੋਆਂ ਖਿੱਚਦੀ ਹਾਂ ਗਣਪਤੀ ਜੀ ਦੀਆਂ ਬਹੁਤ ਫੋਟੋਆਂ ਮੈਂ ਖਿੱਚੀਆਂ ਹਾਂ ਅਤੇ ਜ਼ਿਆਦਾਤਰ ਬੱਚਿਆਂ ਦੀਆਂ ਮੈਂ ਆਪਣੇ ਬੱਚਿਆਂ ਦੀਆਂ ਮੈਂ ਆਪਣੀ ਨਹੀਂ ਕੋਈ ਵੀ ਜਲਦੀ ਆਪਣੀ ਸੈਲਫੀ ਲੈਂਦੀ ਅਤੇ ਸਾਡੇ ਘਰ ਗਲੀ 'ਚ ਜਾਨਵਰ ਕੁੱਤੇ ਵਗੈਰਾ ਰਹਿੰਦੇ ਮੈਂ ਉਹਨਾਂ ਦੀਆਂ ਵੀ ਕਲਿੱਕ ਕਰਦੀ ਰਹਿੰਦੀ ਹਾਂ ਫੋਟੋਆਂ ਮਤਲਬ ਮੈਨੂੰ ਬਹੁਤ ਅੱਛਾ ਲੱਗਦਾ ਹੈਗਾ ਆ ਦੂਜਿਆਂ ਦੀਆਂ ਫੋਟੋਆਂ ਖਿੱਚਣੀਆਂ ਅਤੇ ਘਰ ਦੇ ਵਿੱਚ ਚਿੜੀਆਂ ਦੀਆਂ ਵੀ ਸਾਡੇ ਘਰ ਦੇ ਵਿੱਚ ਇੱਕ ਵਾਰੀ ਚਿੜੀਆਂ ਨੇ ਆਲ੍ਹਣਾ ਬਣਾਇਆ ਮੈਂ ਉਹਨਾਂ ਦੀ ਵੀ ਫੋਟੋ ਖਿੱਚ ਕੇ ਆਪਣੇ ਫੋਨ ਦੇ ਵਿੱਚ ਰੱਖ ਲਿੱਤੀ ਵੀ ਮਤਲਬ ਅੱਛਾ ਲੱਗਦਾ ਹੈਗਾ ਆ ਛੋਟੀਆਂ ਛੋਟੀਆਂ ਚੀਜਾਂ ਦੇ ਵਿੱਚੋਂ ਖੁਸ਼ੀਆਂ ਲੈਣੀਆਂ ਮਤਲਬ ਅੱਛਾ ਮਾਹੌਲ